ਹੈਲੋ ਨਮੀਤਾ ਹਾਂ ਅੱਛਾ ਸੁਣ ਕੀ ਕਹਿੰਦੇ ਹੈ ਅਸੀਂ ਜਾਣਾ ਨਾ ਵੈਸ਼ਨੋ ਦੇਵੀ ਹੋ ਹੋ ਗਈ ਮਤਲਬ ਤੁਹਾਡਾ ਹੋ ਗਿਆ ਪੱਕਾ ਕਿਹਣੇ ਕਿਹਣੇ ਜਾਣਾ ਹੈ ਕਿੰਨੇ ਮੈਂਬਰ ਹੋ ਜਾਵਾਂਗੇ ਅਸੀਂ ਚਾਰ ਅਸੀਂ ਚਾਰ ਤੁਸੀਂ ਦੋ ਮੰਮੀ ਪਾਪਾ ਤਿੰਨ ਮੰਮੀ ਪਾਪਾ ਆਸ਼ੂ ਹੈ ਨਾ ਸਮਝੋ ਅਸੀਂ ਗਿਆਰ੍ਹਾਂ ਜਾਣੇ ਹੋ ਗਏ ਅਤੇ ਸੁਣ ਤੂੰ ਇੱਕ ਵਾਰ ਚੈੱਕ ਕਰ ਲਵੇਂਗੀ ਵੀ ਮਤਲਬ ਟਰੇਨ ਦੀ ਟਿਕਟ ਹੈਗੀ ਹੈ ਹਾਂ ਅਗਰ ਫਸਟ ਏ ਸੀ ਹੋ ਜਾਏ ਫਸਟ ਏ ਸੀ ਦੇਖ ਲਈਂ ਤਾਂ ਥਰਡ ਏ ਸੀ ਦੇਖ ਲਈਂ ਕੋਈ ਵੀ ਮਿਲ ਜਾਏ ਬੈਟਰ ਹੈ ਮਤਲਬ ਚਾਹੇ ਫਸਟ ਮਿਲ ਜਾਏ ਚਾਹੇ ਥਰਡ ਮਿਲ ਜਾਏ ਤੂੰ ਦੇਖ ਲਏਂਗੀ ਮੈਂ ਨਾ ਬਾਹਰ ਹਾਂ ਮੇਰਾ ਨੈਟ ਵੀ ਨਹੀਂ ਚਲਦਾ ਪਿਆ ਮੈਂ ਕਿਹਾ ਮੈਂ ਤੈਨੂੰ ਕਹਿ ਦੇਵਾਂ ਸਲੀਪਰ ਦੇਖ ਲਈਂ ਹਾਂ ਸਲੀਪਰ ਵੀ ਹੁੰਦੇ ਆ ਸਲੀਪਰ ਦੇਖ ਲਈਂ ਔਰ ਕੀ ਨਾਮ ਹੈ ਦ ਡੇਟ ਦੇਖ ਲਈਂ ਕਿ ਰੇਟ ਕੀ ਟਿਕਟ ਹੈ ਨਾ ਫਸਟ ਦਾ ਵੀ ਦੇਖ ਲਈਂ ਥਰਡ ਦਾ ਵੀ ਦੇਖ ਲਈਂ ਔਰ ਫਰਾਈਡੇ ਸ਼ੁੱਕਰਵਾਰ ਰਾਤ ਦੀ ਹਾਂ ਦੇਖ ਲਈਂ ਇੱਕ ਵਾਰ ਔਰ ਨਾ ਦੱਸ ਦਈਂ ਮੈਨੂੰ